ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਹਾਂ ਵਧੀਆ ਵਧੀਆ ਭੈਣ ਜੀ ਰੁਪਿੰਦਰ ਬੋਲਦੇ ਪਏ ਹਾਂਜੀ ਮੈਂ ਸ਼ਹਿਨਾਜ਼ ਬੋਲਣ ਦੀ ਜੇ ਹਾਂਜੀ ਅਤੇ ਮੈਂ ਤੁਹਾਨੂੰ ਪੁੱਛਣਾ ਸੀ ਅੰਮ੍ਰਿਤਸਰ 'ਚ ਭਲਾ ਕੋਈ ਬੈਸਟ ਸਕੂਲ ਦੱਸਿਓ ਮੈਨੂੰ ਮੈਂ ਨਾ ਆਪਣੀ ਭੈਣ ਦੇ ਦੋ ਬੱਚੇ ਆ ਅਤੇ ਉਹਨਾਂ ਨੂੰ ਸਕੂਲ ਪਾਉਣਾ ਵਾ ਅਤੇ

ਹਾਂਜੀ ਹਾਂਜੀ ਅੱਛਾ ਅੱਛਾ ਹਾਂਜੀ ਪੜ੍ਹਾਈ ਪੜੂਈ ਦਾ ਕਿੱਦਾਂ ਪੜ੍ਹਾਈ ਵਧੀਆ ਵਾ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਵੈਸੇ ਮੈਂ ਵੀ ਉਹਨਾਂ ਦਾ ਹੀ ਪੁੱਛਣਾ ਸੀ ਉਹ ਦੋ ਬੱਚੇ ਸੀ ਉਹਨਾਂ ਦੀ ਹਾਂਜੀ ਚਲੋ ਮੈਂ ਇਹ ਹੀ ਪੁੱਛਣਾ ਹੀ ਮੈਮ ਥੈਂਕ ਯੂ ਸੋ ਮਚ ਹਾਂਜੀ